ਵੈਸੇ ਤਾਂ ਜ਼ਿਆਦਾਤਰ ਪੰਜਾਬ 'ਚ ਪੰਜਾਬੀ ਭਾਸ਼ਾ ਹੀ ਬੋਲੀ ਜਾਂਦੀ ਹੈ ਪਰ ਕੁਝ ਪ੍ਰਾਈਵੇਟ ਸਰਕਾਰੀ ਜਿਵੇਂ ਕਿ ਕਈ ਐਸੀਆਂ ਥਾਵਾਂ ਹਨ ਜਿੱਥੇ ਇੰਗਲਿਸ਼ ਨੂੰ ਹਰ ਕੋਈ ਜ਼ਿਆਦਾ ਮਹੱਤਵਪੂਰਨ ਸਮਝਣ ਲੱਗ ਗਿਆ ਹੈ ਜਿਸ ਦੇ ਵਿੱਚ ਸਕੂਲ ਕੋਲੇਜ ਵਗੈਰਾ ਹਰ ਇੱਕ ਜਿੱਥੇ ਜਿੱਥੇ ਇੰਗਲਿਸ਼ ਮੀਡੀਅਮ ਸਕੂਲਾਂ ਦੇ ਹੋਣ ਕਾਰਨ ਪੰਜਾਬੀ ਸਕੂਲ 'ਚ ਕੋਈ ਅੱਜ ਕੱਲ੍ਹ ਆਪਣਾ ਬੱਚਾ ਪੜ੍ਹਾ ਕੇ ਵੀ ਖੁਸ਼ ਨਹੀਂ ਹੈ ਹਰ ਜਗ੍ਹਾ 'ਤੇ ਜ਼ਿਆਦਾ ਇੰਗਲਿਸ਼ ਦੀ ਵਰਤੋਂ ਹੋਣ ਲੱਗ ਗਈ ਹੈ ਜਿਵੇਂ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਇਸ ਨੂੰ ਵੱਧ ਤੋਂ ਵੱਧ ਹਰ ਇੱਕ ਥਾਂ 'ਤੇ ਬੋਲਣਾ ਚਾਹੀਦਾ ਹੈ ਦਫਤਰਾਂ ਦੇ ਵਿੱਚ ਵੀ ਇਸ ਨੂੰ ਜ਼ਿਆਦਾਤਰ ਵਰਤਣਾ ਚਾਹੀਦਾ ਹੈ ਇੰਗਲਿਸ਼ ਦੀ ਵਰਤੋਂ ਜਾਂ ਹੋਰ ਕਿਸੇ ਭਾ ਹੋਰ ਕਿਸੇ ਭਾਸ਼ਾ ਦੀ ਵਰਤੋਂ ਘੱਟ ਹੋਣੀ ਚਾਹੀਦੀ ਹੈ ਪੰਜਾਬੀ ਨੂੰ ਮਹੱਤਵਪੂਰਨ ਦੇਣਾ ਚਾਹੀਦਾ ਹੈ